ਪੰਜਾਬ ਵਿੱਚ ਦੇਖਿਆ ਜਾਵੇ ਤਾਂ ਸਪੋਰਟਸ ਕਾਫੀ ਜ਼ਿਆਦਾ ਕ੍ਰੇਜ਼ ਹੋ ਰਿਹਾ ਹੈ ਖੇਡਾਂ ਦਾ ਵੀ ਕਾਫੀ ਕਰੇਜ਼ ਹੋ ਰਿਹਾ ਹੈ ਅਤੇ ਪੰਜਾਬ ਵਿੱਚ ਹੋਕੀ ਵੈਸੇ ਮਾਂ ਬੋਲੀ ਖੇਡ ਹੈ ਜੋ ਕਿ ਨੈਸ਼ਨਲ ਖੇਡ ਪੰਜਾਬ ਦੀ ਮੰਨਿਆ ਗਿਆ ਹੈ ਅਤੇ ਇਸ ਦੇ ਨਾਲ ਨਾਲ ਕ੍ਰਿਕਟ ਦਾ ਵੀ ਕਾਫੀ ਕਰੇਜ ਹੈ ਜਿਵੇਂ ਕਿ ਹੁਣ ਕ੍ਰਿਕਟ ਦੇ ਵਿੱਚ ਕਿੰਗ ਕਿੰਗ ਪੰਜਾਬ ਟੀਮ ਖੇਡ ਰਹੀ ਹੈ ਜੋ ਕਿ ਹੁਣ ਟਵੰਟੀ ਟਵੰਟੀ ਦੇ ਵਿੱਚ ਖੇਡ ਰਹੀ ਹੈ ਫੁੱਟਬੋਲ ਫੁੱਟਬਾਲ ਦੇ ਵੀ ਕਾਫੀ ਵਧੀਆ ਪਲੇਅਰ ਹੈ ਆਪਣੇ ਪੰਜਾਬ ਦੇ ਵਿੱਚ ਜੋ ਕਿ ਕਾਫੀ ਵੱਡੇ ਪੱਧਰ 'ਤੇ ਖੇਡਦੇ ਹਨ ਅਤੇ ਟੈਨਿਸ ਦੇ ਵਿੱਚ ਵੀ ਆਪਣੇ ਹੁਣ ਪੰਜਾਬ ਦੇ ਵਿੱਚ ਜੋ ਮੌਲ ਵਗੈਰਾ ਹੁੰਦੇ ਆ ਟੈਨਿਸ ਦੇ ਟੇਬਲ ਸੈਟ ਮੌਲਾਂ ਦੇ ਵਿੱਚ ਲਗਾਏ ਜਾਂਦੇ ਹਨ ਅਤੇ ਬੈਲ ਬੈਲ ਮੈਂਟਿੰਗ ਵੀ ਪੰਜਾਬ ਦੇ ਵਿੱਚ ਕਾਫੀ ਵਧੀਆ ਖੇਡੀ ਜਾਂਦੀ ਹੈ ਅਤੇ ਕਾਫੀ ਇਸਦਾ ਵੀ ਕਰੇਜ਼ ਹੈ